ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਡਮ ਜੀ ਮੈਂ ਪਠਾਨਕੋਟ ਆਉਣਾ ਸੀਗਾ ਤੁਹਾਡੇ ਇੱਥੇ ਘੁੰਮਣ ਅਤੇ ਮੈਂ ਪੁੱਛਣਾ ਸੀਗਾ ਵੀ ਕਿਹੜੀ ਕਿਹੜੀ ਲੋਕੇਸ਼ਨ ਕਿਹੜੀ ਕਿਹੜੀ ਤੁਹਾਡੇ ਘੁੰਮਣ ਨੂੰ ਲਾਗੇ ਵਧੀਆ ਹਾਂਜੀ ਕਿਹੜੀ ਕਿਹੜੀ ਜਰਾ ਦੱਸ ਦਿਉਂਗੇ ਮੈਨੂੰ ਤੁਹਾਡੇ ਲੋਕਲ ਪਠਾਨਕੋਟ 'ਚ ਕਿਹੜੀ ਕਿਹੜੀ ਜਗ੍ਹਾ ਘੁੰਮਣ ਵਾਲੀ ਲਾਗੇ ਛਾਗੇ ਏਰੀਏ 'ਚ ਅੱਛਾ ਜੀ ਅਤੇ ਮੋਲ ਮੋਲ ਕਿਹੜੇ ਕਿਹੜੇ ਤੁਹਾਡੇ ਇੱਥੇ ਮੋਲ ਕਿਹੜੇ ਕਿਹੜੇ ਮੋਲ ਅੱਛਾ ਨਵੇਲਟੀ ਮੋਲ ਕਿੰਨਾ ਦੂਰ ਪੈਂਦਾ ਤੁਹਾਡੇ ਕੋਲੋਂ ਠੀਕ ਆ ਜੀ ਅਤੇ ਖਾਣ ਖੁਣ ਨੂੰ ਖਾਣ ਖੁਣ ਨੂੰ ਕੀ ਆ ਉੱਧਰ ਕੋਈ ਵਧੀਆ ਆਈਟਮ ਕੀ ਅੱਛਾ ਜੀ ਹੋਰ ਠੀਕ ਹੈ ਜੀ ਨਾਨ ਵਗੈਰਾ ਚਨੇ ਬੰਦ ਛੋਲੇ ਵਗੈਰਾ ਨਾਨ ਵਗੈਰਾ ਜਾਂ ਹੋਰ ਕੁਝ ਠੀਕ ਆ ਜੀ ਚਲੋ ਮੈਂ ਨੈਕਸਟ ਮੰਡੇ ਨੂੰ ਆ ਰਿਹਾ ਤਾਂ ਫਿਰ ਮੈਂ ਕਿਹਾ ਚਲੋ ਮੈਂ ਤੁਹਾਨੂੰ ਪੁੱਛ ਲੈਂਦਾ ਵਾ ਤਾਂ ਫਰੀ ਹੋ ਨੈਕਸਟ ਮੰਡੇ ਤੁਸੀਂ ਫਰੀ ਹੋ ਹਾਂ ਅਤੇ ਬਸ ਫਿਰ ਨੈਕਸਟ ਮੰਡੇ ਨੂੰ ਆ ਰਿਹਾ ਅਤੇ ਤੁਸੀਂ ਫਿਰ ਸਾਨੂੰ ਗਾਈਡ ਕਰ ਦਿਓ ਨਾਲ ਹੋ ਕੇ ਨਾ ਓਕੇ ਜੀ ਓਕੇ ਮਿਹਰਬਾਨੀ